ਅੱਜ ਕੱਲ੍ਹ ਪਾਣੀ ਜੋ ਕਿ ਸਾਡੇ ਲਈ ਬਹੁਤ ਹੀ ਜ਼ਰੂਰੀ ਹੋ ਚੁੱਕਿਆ ਹੈ ਸਾਡੀ ਸਾਰੀ ਫਸਲ ਪਾਣੀ ਦੇ ਉੱਪਰ ਹੀ ਨਿਰਭਰ ਹੁੰਦੀ ਹੈ ਇਸ ਲਈ ਸਾਨੂੰ ਬਿਜਲੀ ਦੇ ਕਨੈਕਸ਼ਨਾਂ ਦੀ ਲੋੜ ਹੁੰਦੀ ਹੈ ਅਤੇ ਸਰਕਾਰ ਬਿਜਲੀ ਦੇ ਕਨੈਕਸ਼ਨ ਦਿੰਦੀ ਹੈ ਉਹਨਾਂ ਦੇ ਇੱਕ ਪੱਤਰ ਜਾਰੀ ਕੀਤਾ ਜਾਂਦਾ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਨਵੇਂ ਕਨੈਕਸ਼ਨਾਂ ਬਾਰੇ ਫਿਰ ਉਹ ਕਨੈਕਸ਼ਨ ਲਈ ਫਾਰਮ ਭਰੇ ਜਾਂਦੇ ਨੇ ਜਮੀਨ ਦੇ ਉਹ ਕਾਗਜ਼ ਲਗਾ ਕੇ ਫਿਰ ਉਹ ਨਵੇਂ ਕਨੈਕਸ਼ਨ ਨਿਕਲਦੇ ਹਨ ਫਿਰ ਉਸ ਤੋਂ ਬਾਅਦ ਬਿਜਲੀ ਘਰ ਵਿੱਚ ਜਾ ਕੇ ਟਰਾਂਸਫਾਰਮ ਤਾਰਾਂ ਲੋਡ ਭਰਿਆ ਜਾਂਦਾ ਸਮਾਨ ਦਿੱਤਾ ਜਾਂਦਾ ਅਤੇ ਸਮੱਸਿਆਵਾਂ ਇਹ ਨੇ ਕਿ ਜਿਹੜੇ ਕਨੈਕਸ਼ਨ ਨਵੇਂ ਉਹ ਸਰਕਾਰ ਕਈ ਵਾਰ ਲੰਬੇ ਸਮੇਂ ਤੋਂ ਵੀ ਕੱਢਦੀ ਹੈ ਅਤੇ ਕਈ ਵਾਰ ਕਨੈਕਸ਼ਨ ਦਿੱਤੇ ਨਹੀਂ ਜਾਂਦੇ ਕਿਉਂਕਿ ਪਾਣੀ ਦੀ ਉਹ ਕਮੀ ਆ ਬਹੁਤ ਜ਼ਿਆਦਾ ਹੁੰਦੀ ਜਾ ਰਹੀ ਹੈ ਅਤੇ ਕੁਛ ਪੈਸਿਆਂ ਦੀ ਮੰਗ ਕਾਰਣ ਵੀ ਸਮੱਸਿਆ ਆਉਂਦੀਆਂ ਨੇ ਨਵੇਂ ਕਨੈਕਸ਼ਨ ਵੱਧ ਪੈਸਿਆਂ ਉੱਤੇ ਦਿੱਤੇ ਜਾਂਦੇ ਨੇ